ਸਮਾਜਿਕ ਰੁਤਬਾ ਸਮਾਜਿਕ ਮੁੱਲ ਮਾਪ ਦਾ ਮਾਪ ਹੈ ਵਿਸ਼ੇਸ਼ ਤੌਰ 'ਤੇ ਇਹ ਇੱਕ ਸਮਾਜ ਵਿੱਚ ਲੋਕਾਂ ਸਮੂਹਾਂ ਅਤੇ ਸੰਗਠਨਾਂ ਨੂੰ ਸਨਮਾਨ ਯੋਗਤਾ ਅਤੇ ਸਨਮਾਨ ਦੇ ਅਨੁਸਾਰ ਹੀ ਪੱਧਰ ਦਾ ਹਵਾਲਾ ਦਿੰਦਾ ਹੈ ਲੋਕ ਸਰੋਤਾਂ ਲੀਡਰਸ਼ਿਪ ਅਹੁਦਿਆਂ ਅਤੇ ਸ਼ਕਤੀ ਦੇ ਹੋਰ ਕਿਸਮਾਂ ਨੂੰ ਨਿਰਧਾਰਤ ਕਰਨ ਲਈ ਸਥਿਤੀ ਦੀ ਲੜੀ ਦੀ ਵਰਤੋਂ ਕਰਦੇ ਹਨ ਸੰਕੇਤ ਹਨ ਕਿ ਜੋ ਲੋਕ ਨਿਰਧਾਰਿਤ ਕਰਨ ਲਈ ਵਰਤਦੇ ਹਨ ਇੱਕ ਵਿਅਕਤੀ ਕਿੰਨਾ ਰੁਤਬਾ ਰੱਖਦਾ ਹੈ ਉਹਨਾਂ ਨਾਲ ਕਿਵੇਂ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਅਜਿਹੇ ਪ੍ਰਤੀਕਾਂ ਵਿੱਚ ਸਮਾਜਿਕ ਤੌਰ 'ਤੇ ਕੀਮਤੀ ਗੁਣਾਂ ਦਾ ਕਬਜ਼ਾ ਸ਼ਾਮਿਲ ਹੋ ਸਕਦਾ ਹੈ ਜਦੋਂ ਬਹੁਤ ਸਾਰੇ ਵਿਦਵਾਨ ਉਹਨਾਂ ਸ਼ਰਤਾਂ ਨੂੰ ਵੱਖਰਾ ਕਰਦੇ ਹਨ ਅਤੇ ਉਸ ਨੂੰ ਇਸ ਤਰੀਕੇ ਨਾਲ ਪ੍ਰਭਾਸ਼ਿਤ ਕਰਦੇ ਹਨ ਕਿ ਕਿਸੇ ਹੋਰ ਵਿਦਵਾਨ ਦੀ ਪਰਿਭਾਸ਼ਾ ਨਾਲ ਟਕਰਾਉਂਦੀ ਹੈ ਤਾਂ ਉਸ ਵੇਲੇ ਇਹ ਸਥਿਤੀ ਦਾ ਜਿਹੜਾ ਸਮਾਨ ਹੈ ਉਹ ਸਮਾਨ ਅਰਥਕ ਹੋ ਜਾਂਦਾ ਹੈ ਸਥਿਤੀ ਬਾਰੇ ਕੁਝ ਦ੍ਰਿਸ਼ਟੀਕੋਣ ਇਸ ਦੇ ਮੁਕਾਬਲਤਨ ਸਥਿਰ ਅਤੇ ਤਰਲ ਪੱਖਾਂ 'ਤੇ ਜ਼ੋਰ ਦਿੰਦੇ ਹਨ ਹੋਰ ਪਰਿਪੇਖ ਜਿਵੇਂ ਕਿ ਸਥਿਤੀ ਵਿਸ਼ੇਸ਼ਤਾਵਾਂ ਦੇ ਸਿਧਾਂਤ ਇੱਕ ਮਾਸਟਰ ਰੁਤਬੇ ਦੇ ਵਿਚਾਰ ਨੂੰ ਰੋਕਦੇ ਹਨ ਸੋਸ਼ਲ ਨੈਟਵਰਕ ਵਿਸ਼ਲੇਸ਼ਣ ਖੋਜਕਰਤਾਵਾਂ ਨੇ ਦਿਖਾਇਆ ਹੈ ਕਿ ਕਿਸੇ ਦੀ ਮਾਨਤਾ ਵੀ ਰੁਤਬੇ ਦਾ ਸਰੋਤ ਹੋ ਸਕਦੀ ਹੈ ਕਈ ਅਧਿਐਨ ਦਸਤਾਵੇਜ਼ ਜੋ ਪ੍ਰਸਿੱਧ ਹਨ ਜਾਂ ਹਾਣੀਆਂ ਉੱਥੇ ਦਬਦਬਾ ਦਿਖਾਉਣਾ ਇੱਕ ਵਿਅਕਤੀ ਦੀ ਸਥਿਤੀ ਵਿੱਚ ਵਾਧਾ ਕਰਦਾ ਹੈ ਵੱਖ ਵੱਖ ਸੋਸਾਇਟੀਆਂ ਵਿੱਚ ਭਾਵੇਂ ਰਸਮੀ ਜਾਂ ਗੈਰ ਰਸਮੀ ਸਟੇਟਸ ਲੜੀ ਸਾਰੇ ਸਮਾਜਾਂ ਵਿੱਚ ਮੌਜੂਦ ਹਨ ਇੱਕ ਸਮਾਜ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਅਨੁਸਾਰੀ ਸਨਮਾਨ ਅਤੇ ਸਤਿਕਾਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇੱਕ ਵਿਅਕਤੀ ਸਮਾਜ ਦੇ ਟੀਚਿਆਂ ਅਤੇ ਆਦਰਸ਼ਾਂ ਨੂੰ ਕਿੰਨੀ ਚੰਗੀ ਤਰ੍ਹਾਂ ਨਾਲ ਸਮਝ ਸਕਦਾ ਹੈ ਆਧੁਨਿਕ ਸਮਾਜਾਂ ਵਿੱਚ ਖਿੱਤੇ ਨੂੰ ਆਮ ਤੌਰ 'ਤੇ ਰੁਤਬੇ ਦਾ ਮੁੱਖ ਨਿਰਧਾਰਿਤ ਮੰਨਿਆ ਜਾਂਦਾ ਹੈ ਇਹ ਚਿੱਤਰ ਅਵਸਥਾ ਪ੍ਰਾਪਤ ਕੀਤੀ ਜਾਂਦੀ ਹੈ ਜੋ ਅਕਸਰ ਉਹਨਾਂ ਨੂੰ ਮਹੱਤਵਪੂਰਨ ਕਦਰਾਂ ਕੀਮਤਾਂ ਰਾਜਨੀਤਿਕ ਸ਼ਕਤੀ ਵਿਦਿਅਕ ਅਕਲ ਅਤੇ ਵਿੱਤੀ ਦੌਲਤ ਨਾਲ ਮੇਲ ਕਰਨ ਵਿੱਚ ਸਫਲਤਾ ਬਾਰੇ ਨਿਰਮਲਾ ਕਰਦਾ ਹੈ ਕਈ ਮਾਮਲਿਆਂ ਵਿੱਚ ਸਥਿਤੀ ਵਿਸ਼ੇਸ਼ ਵਿਅਕਤੀਤਵ ਸੰਬੰਧਾਂ ਨਾਲ ਤੱਕ ਸੀਮਤ ਰਹਿ ਜਾਂਦੀ ਹੈ ਹਾਲਾਂਕਿ ਸੰਦ ਸਾਧਨਾਂ ਅਤੇ ਵਿਸ਼ੇਸ਼ ਅਧਿਕਾਰਾਂ ਵਿੱਚ ਮਾਮੂਲੀ ਅਸਮਾਨਤਾ ਨੂੰ ਅਣਉਚਿਤ ਸਮਝਿਆ ਜਾਂਦਾ ਹੈ ਇਸ ਤਰ੍ਹਾਂ ਹੇਠਲੇ ਰੁਤਬੇ ਵਾਲੇ ਲੋਕ ਤੁਰੰਤ ਬਦਲਾ ਅਤੇ ਵਿਰੋਧਤਾ ਨੂੰ ਮੰਨਿਆ ਜਾਂਦਾ ਹੈ ਪਰ ਜੇ ਕੁਝ ਵਿਅਕਤੀਆਂ ਨੂੰ ਦੂਜਿਆਂ ਨਾਲੋਂ ਵਧੀਆ ਦੇਖਿਆ ਜਾਂਦਾ ਹੈ ਤਾਂ ਇਹ ਕੁਦਰਤੀ ਅਤੇ ਨਿਰਪੱਖ ਲੱਗਦਾ ਹੈ ਕਿ ਉੱਚੇ ਦਰਜੇ ਦੇ ਲੋਕ ਵਧੇਰੇ ਸਰੋਤ ਅਤੇ ਅਧਿਕਾਰ ਪ੍ਰਾਪਤ ਕਰਦੇ ਹਨ ਧੰਨਵਾਦ ਜੀ